ਰਾਜ ਦੀਆਂ ਅਧਿਆਤਮਿਕ ਪ੍ਰੰਪਰਾਵਾਂ ਨੂੰ ਅਨੁਭਵ ਕਰਨ ਲਈ ਕਾਫ਼ੀ ਕੁਛ ਹੈਗਾ ਜਿਵੇਂ ਤੁਸੀਂ ਜੇ ਤੁਸੀਂ ਦੀਵਾਲੀ ਦੇ ਟੈਮ 'ਤੇ ਕਿਸੇ ਥਾਂ ਥਾਵਾਂ 'ਤੇ ਜਾਓ ਜਿਵੇਂ ਪੰਜਾਬ ਵਿੱਚ ਹੀ ਰਹੋ ਤੁਹਾਨੂੰ ਕਿਤ ਕਾਫ਼ੀ ਸਾਰੇ ਲੋਕ ਮਿਲਦੇ ਹੈ ਵੱਖਰੇ ਵੱਖਰੇ ਚੀਜ਼ਾਂ ਲੈਂਦੇ ਹੋਏ ਜਿਵੇਂ ਦੀਵੇ ਹੋ ਗਏ ਦੀਵਾਰਾਂ ਵਾਸਤੇ ਡੈਕੋਰੇਸ਼ਨ ਹੋ ਗਈ ਉਹ ਹੈਪੀ ਦੀਵਾਲੀ ਵਾਲੇ ਪੋਸਟਰ ਹੋ ਗਏ ਸਾਰੇ ਉਨ੍ਹਾਂ ਨੇ ਆਪਣੇ ਘਰਾਂ ਉੱਤੇ ਲਾਉਣੇ ਹੁੰਦੇ ਹੈ ਜਾਂ ਉੱਥੇ ਵੀ ਚੀਜ਼ਾਂ ਕਰਨਾ ਕਿ ਪਟਾਕੇ ਵਗੈਰਾ ਲੈਣੇ ਆਪਣੇ ਘਰ ਵਾਸਤੇ ਫੋੜਨ ਵਾਸਤੇ ਤਾਂ ਕਿ ਜ਼ੋਰਾਂ ਸ਼ੋਰਾਂ ਨਾਲ ਮਨਾਈ ਜਾਵੇ ਲੈਟਾਂ ਲੈਣੀਆਂ ਘਰਾਂ ਨੂੰ ਸਜਾਉਣਾ ਘਰਾਂ ਨੂੰ ਸਜਾਉਣਾ ਚੀਜ਼ਾਂ ਕਰਨਾ ਤੁਸੀਂ ਉੱਥੇ ਜਾਓ ਕ ਜਿਵੇਂ ਰਾਜਸਥਾਨ ਹੋ ਗਿਆ ਰਾਜਸਥਾਨ ਵਿੱਚ ਜੈਪੁਰ ਵਿੱਚ ਵਿੱਚ ਕਾਫ਼ੀ ਚੀਜ਼ਾਂ ਹੈਗੀਆਂ ਜਿੱਥੇ ਜੇ ਉੱਥੇ ਉੱਧਰ ਦੀ ਦੀਵਾਲੀ ਸਭ ਤੋਂ ਜ਼ਿਆਦਾ ਵਧੀਆ ਮਨਾਈ ਮਨਾਉਣੀ ਬ ਬੋਲੀ ਜਾਂਦੀ ਹੈਗੀ ਕਿ ਉੱਧਰ ਸਭ ਤੋਂ ਜ਼ਿਆਦਾ ਵਧੀਆ ਦੀਵਾਲੀ ਮਨਾਈ ਜਾਂਦੀ ਹੈਗੀ ਤਾਂ ਨਾ ਉੱਥੇ ਜਾ ਕੇ ਐਕਸਪੀਰੀਐਂਸ ਕਰਨਾ ਚੀਜ਼ਾਂ ਨੂੰ ਉੱਥੇ ਜਾ ਕੇ ਵੇਖਣਾ ਕਿ ਕਿੱਦਾਂ ਹੁੰਦਾ ਪਿਆ ਕੀ ਕੀ ਹੁੰਦਾ ਪਿਆ ਆਹ ਹੋ ਗਿਆ ਅਤੇ ਧਾਰਮਿਕ ਚੀਜ਼ਾਂ ਹੋ ਗਈਆਂ ਜਿਵੇਂ ਕੋਈ ਧਾਰਮਿਕ ਫੈਸਟੀਵਲ ਹੋ ਗਿਆ ਉੱਧਰ ਜਾ ਕੇ ਮੰਦਰਾਂ ਗੁਰਦੁਆਰਿਆਂ ਵਿੱਚ ਜਾ ਕੇ ਬਹਿਣਾ ਵੇਖਣਾ ਕਿ ਕੀ ਕੀ ਹੁੰਦਾ ਪਿਆ ਵਾ ਜਿਵੇਂ ਕਪੂਰਥਲੇ ਵਿੱਚ ਉਹਦਾ ਇੱਧਰ ਪੰਜ ਮੰਦਰ ਹੈਗਾ ਇੱਥੇ ਜਨਮਾਸ਼ਟਮੀ ਦੇ ਟੈਮ 'ਤੇ ਬਥੇਰੀਆਂ ਸਜਾਵਟਾਂ ਹੁੰਦੀਆਂ ਨੇ ਕਿ ਕ੍ਰਿਸ਼ਨਾ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਕ੍ਰਿਸ਼ਨਾ ਕ੍ਰਿਸ਼ਨਾ ਦੀ ਭਗਵਾਨ ਕ੍ਰਿਸ਼ਨ ਦੀ ਡਰੈਸਾਂ ਵਗੈਰਾ ਪਹਿਨਾ ਕੇ ਉਨ੍ਹਾਂ ਨੂੰ ਬਿਠਾਇਆ ਜਾਂਦਾ ਵਾ ਜਾਂ ਲੋਕਾਂ ਨੂੰ ਵੱਖ ਵੱਖ ਭਗਵਾਨਾਂ ਦੀ ਕੱਪੜੇ ਵਗੈਰਾ ਪਵਾ ਕੇ ਉਨ੍ਹਾਂ ਨੂੰ ਬਿਠਾਇਆ ਜਾਂਦਾ ਵਾ ਤਾਂ ਕਿ ਉਹ ਸ਼ੋ ਕਰਨ 'ਤੇ ਉਨ੍ਹਾਂ ਦੀ ਮੂਰਤੀਆਂ ਵਗੈਰਾ 'ਤੇ ਨੂੰ ਖਿਲਾਏ ਖਾਣਾ ਖੂਣਾ ਖਿਲਾਇਆ ਜਾਂਦਾ ਵਾ ਜਾਂ ਵੱਖਰੇ ਦੇ ਜਨਮਾਸ਼ਟਮੀ ਦੇ ਬਾਅਦ ਜਿੱਦਾਂ ਵੱਜਦੇ ਆ ਉੱਥੇ ਪਟਾਕੇ ਫੋੜੇ ਜਾਂਦੇ ਹੈ ਇਹ ਤਾਂ ਜੀ ਬਹੁਤ ਵਧੀਆ ਵਧੀਆ ਚੀਜ਼ਾਂ ਹੈਗੀਆਂ ਜਿੱਥੇ ਤੁਸੀਂ ਸਾਰਾ ਕੁਛ ਐਕਸਪੀਰੀਐਂਸ ਕਰ ਸਕਦੇ ਹੋ ਸਾਰਾ ਕੁਛ ਵੇਖ ਸਕਦੇ ਕਿ ਕੀ ਕੀ ਹੁੰਦਾ ਪਿਆ ਇੱਧਰ